ਮੌਜੂ ਮੌਜੂਦਾ ਦ੍ਰਿਸ਼ ਵਿੱਚ ਵਿਗਿਆਪਨ ਅਤੇ ਵਧੇਰੇ ਲੋਕਾਂ ਤੱਕ ਪਹੁੰਚਾਉਣ ਦੇ ਹੋਰ ਵੀ ਕਈ ਤਰੀਕੇ ਹਨ ਜਿਵੇਂ ਕਿ ਟੈਲੀਵਿਜ਼ਨ ਅਖਬਾਰ ਐਡਵਰਟੀਜ਼ਮੈਂਟ ਵਿਗਿਆਪਨ ਆਦਿ ਹੋਰ ਵੀ ਕਈ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਕਰਕੇ ਆਪਾਂ ਆਪਣੇ ਸੰਦੇਸ਼ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਸਾਡੇ ਖੁਦ ਦੀ ਇੱਕ ਫੈਮਲੀ ਵਿੱਚ ਇਹ ਦ੍ਰਿਸ਼ ਦੇਖਿਆ ਗਿਆ ਹੈ ਕਿ ਮੇਰੀ ਇੱਕ ਕਜ਼ਨ ਸੀ ਉਹਦਾ ਰਿਸ਼ਤਾ ਅਖਬਾਰ ਜ਼ਰੀਏ ਹੋਇਆ ਸੀ ਉਸ ਲੜਕੇ ਦਾ ਬਾਇਓਡਾਟਾ ਸਾਰਾ ਅਖਬਾਰ ਵਿੱਚ ਵਿਗਿਆਪਨ ਵਿੱਚ ਦਿੱਤਾ ਗਿਆ ਸੀ ਉਸਦੀ ਉਮਰ ਉਸਦਾ ਐਡਰੈੱਸ ਮੋਬਾਇਲ ਨੰਬਰ ਸਭ ਕੁਛ ਫਿਰ ਉਹਨਾਂ ਨੇ ਉਹਦੇ ਨਾਲ ਸੰਪਰਕ ਕਰਕੇ ਉਸ ਰਿਸ਼ਤੇ ਨੂੰ ਕਰ ਦਿੱਤਾ ਅਤੇ ਅੱਜ ਦੇ ਦਿਨ ਤੱਕ ਬਹੁਤ ਸੋਹਣੀ ਤਰ੍ਹਾਂ ਉਹ ਰਿਸ਼ਤਾ ਨਿਭ ਰਿਹਾ ਹੈ ਸਾਡੇ ਸਾਰਿਆਂ ਲਈ ਇਹ ਬਹੁਤ ਰਚਨ ਰਚਨਾਤਮਕ ਅਤੇ ਪ੍ਰਭਾਵਸ਼ਾਲੀ ਰਿਹਾ